ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਅੱਛਾ ਜੀ ਮੋਹਾਲੀ ਤੋਂ ਆਪਣੀ ਆਨੰਦਪੁਰ ਸਾਹਿਬ ਜਾਂਦੀ ਹੈ ਨੰਗਲ ਡੈਮ ਜਾਂਦੀ ਹੈ ਇੱਕ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਠੀਕ ਹੈ ਅਤੇ ਇੱਕ ਹਰਿਮੰਦਰ ਸਾਹਿਬ ਜਾਂਦੀ ਹੈ ਅੰਬਰਸਰ ਅਤੇ ਅੰਬਰਸਰ ਵਾਲੀ ਹੈ ਜਿਹੜੀ ਉਹ ਸਵੇਰੇ ਪੰਜ ਸਵੇਰੇ ਜਾਂਦੀ ਹੈ ਸਵੇਰ ਦਾ ਟਾਈਮ ਹੈ ਉਹਦਾ ਉਹ ਜ਼ਿਆਦਾ ਪੰਜ ਸੱਤ ਮਿੰਟ ਹੀ ਰੁਕਦੀ ਹੈ ਨਹੀਂ ਫਿਰ ਦੁਬਾਰਾ ਬੁੱਕ ਕਰਵਾਉਣੀ ਪਵੇਗੀ ਜੇ ਲੇਟ ਹੋ ਗਏ ਤੁਸੀਂ

ਸ਼ਾਮ ਨੂੰ ਜੀ ਹਾਂਜੀ ਪੰਜ ਸਾਢੇ ਪੰਜ ਵਜੇ ਦਾ ਟਾਈਮ ਹੈ ਸਾਢੇ ਪੰਜ ਵਜੇ ਦਾ ਹਾਂ ਖਾਣਾ ਖਾਣਾ ਪੀਣਾ ਵਿੱਚ ਹੀ ਹੁੰਦਾ ਆਪਣਾ ਆਪਣੀ ਮਰਜ਼ੀ ਦਾ ਖਾਣਾ ਬਾਹਰ ਆਪਣੀ ਮਰਜ਼ੀ ਦਾ ਖਾ ਲਓ

ਹਾਂਜੀ ਏਸੀ ਵਾਲੀ ਵੀ ਹੁੰਦੀ ਹੈ ਜੀ ਨੋਨ ਏਸੀ ਵੀ ਹੁੰਦੀ ਹੈ ਜਿਹੜਾ ਏਸੀ ਵਾਲਾ ਡੱਬਾ ਹੈ ਉਹਦੀ ਟਿਕਟ ਹੈਗੀ ਤਿੰਨ ਸੌ ਪੰਝੱਤਰ ਰੁਪਈਆ ਜਿਹੜਾ ਨੋਨ ਏਸੀ ਹੈ ਉਹਦਾ ਹੈਗਾ ਇੱਕ ਸੌ ਪੰਝੱਤਰ ਰੁਪਈਆ

ਸਫ਼ਾਈ ਐਨ ਸਾਫ਼ ਸੁਥਰੀ ਹੋਵੇਗੀ ਸਫ਼ਾਈ ਦੀ ਕੋਈ ਕਮੀ ਨਹੀਂ ਹੈਗੀ ਹਾਂਜੀ ਸਫ਼ਾਈ ਦਾ ਇੱਕ ਮਾੜੀ ਜਿਹੀ ਚੀਜ਼ ਨਹੀਂ ਸਫ਼ਾਈ ਕੋਈ ਬਿਲਕੁਲ ਐਨ ਸਾਫ਼ ਹੋਵੇਗਾ ਸੁਥਰਾ ਡੱਬਾ ਹਾਂਜੀ ਹੋਰ ਠੀਕ ਹੈ ਥੈਂਕ